ਮੈਂ ਪੰਜਾਬ ਦੀ ਰਹਿਣ ਵਾਲੀ ਹਾਂ ਅਤੇ ਮੈਂ ਸਵਿਗੀ ਐਪ ਤੋਂ ਕੁਝ ਸਮਾਨ ਆਰਡਰ ਕੀਤਾ ਸੀ ਅਤੇ ਉਹ ਡਿਲੀਵਰੀ ਬੋਆਏ ਥੋੜ੍ਹਾ ਲੇਟ ਹੋ ਗਿਆ ਸੀ ਅਤੇ ਉਹ ਜਦੋਂ ਆਇਆ ਉਹ ਮੇਰੇ ਨਾਲ ਗੱਲਾਂ ਕਰਨ ਲੱਗ ਪਿਆ ਜਿਵੇਂ ਕਿ ਮੇਰੇ ਘਰਦੇ ਕਿੱਥੇ ਆ ਤੁਸੀਂ ਕਿਵੇਂ ਹੋ ਵਗੈਰਾ ਵਗੈਰਾ ਅਤੇ ਮੈਂ ਉਸ ਨੂੰ ਕੋਈ ਵੀ ਜਵਾਬ ਦਾ ਉੱਤਰ ਦੇਣਾ ਜ਼ਰੂਰੀ ਨਹੀਂ ਸਮਝਿਆ ਕਿਉਂਕਿ ਉਹ ਬਹੁਤ ਹੀ ਗਲਤ ਨਜ਼ਰੀਏ ਨਾਲ ਮੈਨੂੰ ਵੇਖ ਰਿਹਾ ਸੀ ਅਤੇ ਉਹ ਵਾਰ ਵਾਰ ਮੈਨੂੰ ਹੱਥ ਲਗਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਜਿਵੇਂ ਕਿ ਮੈਂ ਘਰ ਇਕੱਲੀ ਸੀ ਅਤੇ ਮੇਰੇ ਘਰ ਦੇ ਮੇਰੇ ਘਰ ਨਹੀਂ ਸੀ ਅਤੇ ਮੈਂ ਜਦੋਂ ਉ ਉਹਨੇ ਮੈਨੂੰ ਜਦੋਂ ਆਰਡਰ ਫੜਾਇਆ ਤਾਂ ਉਹ ਮੈਨੂੰ ਹੱਥ ਲਗਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਅਤੇ ਜਦੋਂ ਮੈਂ ਉਹਨੂੰ ਅੰਦਰ ਗਈ ਅਤੇ ਮੈਂ ਉਹਨੂੰ ਪੈਸੇ ਦੇਣ ਬਾਹਰ ਆਈ ਤਾਂ ਉਹ ਉਹਨੇ ਤਾਂ ਵੀ ਮੈਨੂੰ ਹੱਥ ਲਗਾਉਣ ਦੀ ਬਹੁਤ ਕੋਸ਼ਿਸ਼ ਕੀਤੀ ਅਤੇ ਮੈਂ ਉਹਨੂੰ ਕਿਹਾ ਕਿ ਤੁਸੀਂ ਮੈਨੂੰ ਵਾਰ ਵਾਰ ਹੱਥ ਲਗਾਉਣ ਦੀ ਕੋਸ਼ਿਸ਼ ਕਿਉਂ ਕਰ ਰਹੇ ਹੋ ਤਾਂ ਉਹ ਡਰਾਮੇ ਕਰਨ ਸ਼ੁਰੂ ਕਰ ਪਿਆ ਕਿ ਕੁਝ ਨਹੀਂ ਉਹ ਗਲਤੀ ਨਾਲ ਲੱਗ ਗਿਆ ਸੀ ਇਹ ਵੋ ਅਤੇ ਮੈਂ ਉਹਨੂੰ ਆਪਣੇ ਓ ਕੋਲੋਂ ਦੂਰ ਕੀਤਾ ਉਹ ਮੇਰੇ ਵਾਰ ਵਾਰ ਨੇੜੇ ਆਉਣ ਦੀ ਕੋਸ਼ਿਸ਼ ਕਰ ਰਿਹਾ ਸੀ ਅਤੇ ਮੈਂ ਉਹਨੂੰ ਆਪਣੇ ਨਾਲੋਂ ਦੂਰ ਕੀਤਾ ਅਤੇ ਮੈਂ ਜੋਰ ਦੀ ਬੋਲਿਆ ਕਿ ਮੈਨੂੰ ਹੱਥ ਨਹੀਂ ਲਗਾਉਣਾ ਅਤੇ ਮੇਰੇ ਗਲੀ ਵਾਲੇ ਜੋ ਮੇਰੇ ਨਾਲ ਘਰ ਸੀ ਉਹ ਬਾਹਰ ਆਏ ਅਤੇ ਉਹਨਾਂ ਨੇ ਪੁੱਛਿਆ ਕੀ ਹੋਇਆ ਅਤੇ ਮੈਂ ਸਾਰਾ ਕੁਝ ਦੱਸਿਆ ਕਿ ਇਹ ਮੈਨੂੰ ਹੱਥ ਲਗਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਗਲਤ ਤਰੀਕੇ ਨਾਲ ਵੇਖ ਰਿਹਾ ਸੀ ਅਤੇ ਉਹਨੇ ਉਹਨਾਂ ਨੇ ਫਿਰ ਮੇਰੇ ਮਾਪਿਆਂ ਨੂੰ ਫੋਨ ਕੀਤਾ ਅਤੇ ਮੇਰੇ ਪਾਪਾ ਘਰ ਆਏ ਅਤੇ ਉਹਨਾਂ ਨੇ ਪੁੱਛਿਆ ਇਹ ਕੀ ਕੀ ਕਰਿਆ ਕਰਨਾ ਕੀ ਹੋਇਆ ਅਤੇ ਮੈਂ ਉਹਨਾਂ ਨੂੰ ਕਿਹਾ ਕਿ ਇਹਨੇ ਮੈਨੂੰ ਹੱਥ ਲਗਾਉਣ ਦੀ ਕੋਸ਼ਿਸ਼ ਕੀਤੀ ਹੈ ਗਲਤ ਨਜ਼ਰੀਏ ਨਾਲ ਵੇਖ ਰਿਹਾ ਸੀ ਅਤੇ ਮੇਰੇ ਪਾਪਾ ਨੇ ਉਹਦਾ ਨਾਮ ਪਤਾ ਐਡਰੈਸ ਫੋਨ ਨੰਬਰ ਲਿੱਤਾ ਅਤੇ ਪਾਪਾ ਨੇ ਉਸ ਟਾਈਮ ਉਸ ਨੂੰ ਛੱਡ ਦਿੱਤਾ ਬਾਕੀ ਸਾਰੇ ਕਹਿ ਰਹੇ ਸੀ ਕਿ ਛੱਡ ਦਿਓ ਬਟ ਪਾਪਾ ਕਹਿ ਰਹੇ ਸੀ ਕਿ ਨਹੀਂ ਮੈਂ ਇਹਨੂੰ ਪੁਲਿਸ ਵੱਲ ਫੜਾਉਣਾ ਬਟ ਫਿਰ ਮੰਮੀ ਨੇ ਵੀ ਕਿਹਾ ਕਿ ਇ ਇਸ ਵਾਰ ਛੱਡ ਦਿਓ ਅਤੇ ਉਹਨਾਂ ਨੇ ਉਸ ਬੰਦੇ ਨੂੰ ਛੱਡ ਦਿੱਤਾ ਅਤੇ ਉਸ ਮੈਂ ਚਾਹੁੰਦੀ ਹਾਂ ਕਿ ਤੁਸੀਂ ਉਸ ਬੰਦੇ ਲਈ ਸਖ਼ਤ ਤੋਂ ਸਖ਼ਤ ਐਕਸ਼ਨ ਲਵੋ ਅਤੇ ਉਸਨੂੰ ਪੁਲਿਸ ਵੱਲ ਸੌਂਪ ਦਿਓ ਤਾਂ ਕਿ ਉਹ ਅੱਗੇ ਤੋਂ ਇਹੋ ਹੀ ਜਿਹੀ ਹਰਕਤ ਕਿਸੇ ਹੋਰ ਕੁੜੀ ਨਾਲ ਨਾ ਕਰ ਸਕੇ ਉਸ ਮੁੰਡੇ ਦਾ ਨਾਂ ਨਿਤਿਨ ਸ਼ਰਮਾ ਸੀ ਅਤੇ ਮੈਂ ਚਾਹੁੰਦੀ ਹਾਂ ਕਿ ਇਸ ਲਈ ਸਭ ਤੋਂ ਸਖ਼ਤ ਐਕਸ਼ਨ ਲਿੱਤਾ ਜਾਵੇ ਤਾਂ ਕਿ ਜੋ ਅੱਗੇ ਹੋਣ ਵਾਲੀਆਂ ਕੁੜੀਆਂ ਜਦੋਂ ਔਡਰ ਕਰਨਗੀਆਂ ਤਾਂ ਉਹਨਾਂ ਨੂੰ ਵੀ ਇਹ ਹੀ ਚੀਜ਼ਾਂ ਦਾ ਇਹ ਹੀ ਚੀਜ਼ਾਂ ਨੂੰ ਫੇਸ ਕਰਨਾ ਪਵੇਗਾ ਅਤੇ ਮੈਂ ਚਾਹੁੰਦੀ ਹਾਂ ਕਿ ਤੁਸੀਂ ਉਸ ਬੰਦੇ ਖਿਲਾਫ ਸਖ਼ਤ ਤੋਂ ਸਖ਼ਤ ਐਕਸ਼ਨ ਲਵੋ